ਸਿੱਖਿਆ ਨੂੰ ਉਤਸਾਹਿਤ ਕਰਨ ਲਈ ਸਰਕਾਰ ਲੜਕੀਆਂ ਨੂੰ ਸਾਈਕਲ ਜਾਂ ਲੈਪਟੋਪ ਦੇਨ ਵਰਗੀਆਂ ਸਕੀਮਾਂ ਦੇ ਰਹੀ ਹੈ ਇਸ ਦਾ ਲੜਕੀਆਂ ਨੂੰ ਫਾਇਦਾ ਇਹ ਹੈਗਾ ਕਿ ਉਹ ਸਕੂਲ ਤੋਂ ਬਾਅਦ ਕਾਲਜ ਜਾ ਕੇ ਪੜ੍ਹਾਈ ਕਰ ਸਕਦੀਆਂ ਅਤੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਦੀਆਂ ਅਤੇ ਨੁਕਸਾਨ ਉਹਦਾ ਇਹ ਹੈ ਕਿ ਉਹਨਾਂ ਨਾਲ ਕਈ ਵਾਰੀ ਰਸਤੇ ਵਿੱਚ ਕੋਈ ਦੁਰਘਟਨਾ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਲੈਪਟੋਪ ਵੀ ਪੜ੍ਹਾਈ ਵਿੱਚ ਬਹੁਤ ਸਹਾਇਤਾ ਕਰਦਾ ਪਰ ਬੱਚੇ ਇਸਦਾ ਅੱਜ ਕੱਲ੍ਹ ਗਲਤ ਇਸਤੇਮਾਲ ਕਰ ਰਹੇ ਹਨ ਥੈਂਕਸ